ਮੇਰੇ ਲਈ ਲਿਖਣ ਦਾ ਸਭ ਤੋਂ ਚੁਣੌਤੀਪੂਰਨ ਪਹਿਲੂ ਇਹ ਹੈ ਕਿ ਸੋਚ ਸਮਝ ਕੇ ਲਿਖਣਾ ਬਹੁਤ ਜ਼ਿਆਦਾ ਮੁਸ਼ਕਿਲ ਕੰਮ ਹੈ ਕਿਉਂਕਿ ਸੋਚ ਕੇ ਲਿਖਣਾ ਵਾਰ ਵਾਰ ਉਹਨੂੰ ਸਮਝ ਕੇ ਲਿਖਣਾ ਕਈ ਵਾਰ ਸਾਰਾ ਲਿਖਿਆ ਜਾਂਦਾ ਏ ਬਟ ਫ਼ਿਰ ਵੀ ਇੱਕ ਨਾ ਕੁਝ ਨਾ ਕੁਝ ਗਲਤੀ ਰਹਿ ਹੀ ਜਾਂਦੀ ਹੈ ਇਸ ਲਈ ਮੇਰੇ ਲਈ ਸੋਚ ਸਮਝ ਕੇ ਲਿਖਣਾ ਬਹੁਤ ਹੀ ਚੁਣੌਤੀਪੂਰਨ ਕੰਮ ਹੈ ਅਤੇ ਮੈਂ ਇਹਨੂੰ ਪਾਰ ਇਸ ਤਰਾਂ ਕਰਦੀ ਹਾਂ ਕਿ ਮੈਂ ਬਾਰ ਬਾਰ ਲਿਖ ਕੇ ਬਾਰ ਬਾਰ ਅਭਿਆਸ ਕਰਕੇ ਉਹਨੂੰ ਸਮਝ ਕੇ ਸੋਚ ਕੇ ਸ਼ਾਂਤਮਈ ਜਗ੍ਹਾ 'ਤੇ ਬੈਠ ਕੇ ਕਿਸੇ ਜਿੱਥੇ ਕੋਈ ਵੀ ਸ਼ੋਰ ਨਾਲ ਹੁੰਦਾ ਹੋਵੇ ਉੱਥੇ ਜਾ ਕੇ ਲਿਖਦੀ ਹਾਂ ਅਤੇ ਲਿਖ ਕੇ ਉਹਨੂੰ ਵਾਰ ਵਾਰ ਪੜਦੀ ਹਾਂ ਦੇਖਦੀ ਹਾਂ ਕਿ ਮੇਰੇ ਤੋਂ ਕੁਝ ਗਲਤ ਤਾਂ ਨਹੀਂ ਲਿਖਿਆ ਗਿਆ ਅਗਰ ਲਿਖਿਆ ਗਿਆ ਤਾਂ ਮੈਂ ਦੁਬਾਰਾ ਉਹਨੂੰ ਉਹਨੂੰ ਉਹਨੂੰ ਦੇਖ ਕੇ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਹਾਂ ਇਸ ਤਰ੍ਹਾਂ ਮੈਂ ਇਹਨੂੰ ਆਪਣੇ ਚੁਣੌਤੀਪੂਰਨ ਪਹਿਲੂ ਨੂੰ ਪਾਰ ਕਰ ਲੈਂਦੀ ਹਾਂ ਅਤੇ ਵਾਈਟਸ ਬਲੋਕਰ ਕ੍ਰੀਏਟਿਵ ਬਲੋਗ ਬਾਰੇ ਮੈਂ ਸੁਣਿਆ ਵੀ ਹੈ ਲਿਖਿਆ ਵੀ ਹੈ ਕਿਉਂਕਿ ਵਾਈਟਰ ਕ੍ਰੀਏਟਿਵ ਬਲੋਕ ਉਹ ਹੁੰਦਾ ਜਿਹਤੇ ਅਸੀਂ ਆਪਣੀ ਕਰ ਰਾਈਟਿੰਗ ਨੂੰ ਹੋਰ ਜ਼ਿਆਦਾ ਕ੍ਰੀਏਟਿਵ ਬਣਾਉਂਦੇ ਹਾਂ ਹੋਰ ਜ਼ਿਆਦਾ ਇੰਪਰੂਵਮੈਂਟ ਕਰਦੇ ਹਾਂ ਉਹਨੂੰ ਅਸੀਂ ਸੁਧਾਰ ਲੈ ਕੇ ਆਉਂਦੇ ਹਾਂ ਵਾਰ ਵਾਰ ਲਿਖ ਕੇ ਬਾਰ ਬਾਰ ਪ੍ਰੈਕਟਿਸ ਕਰਕੇ ਉਹਨੂੰ ਲਿਖਦੇ ਹਾਂ ਤਾਂ ਜੋ ਸਾਡੀ ਜਿਹੜੀ ਰਾਈਟਿੰਗ ਆ ਉਹ ਸੁਧਰ ਸਕੇ ਮਤਲਬ ਦੇਖਣੇ ਨੂੰ ਵਧੀਆ ਲੱਗੇ ਅਸੀਂ ਪੜ੍ਹੀਏ ਤਾਂ ਉਹਨੂੰ ਉਹਦੇ ਵਿੱਚ ਸਾਨੂੰ ਕੁਝ ਨਾ ਕੁਝ ਦੇ ਸਿੱਖਣ ਨੂੰ ਮਿਲੇ ਇਸ ਤਰ੍ਹਾਂ ਕ੍ਰੀਏਟਿਵ ਲਿਖਦੀ ਹਾਂ ਅਤੇ ਲਿਖ ਲਿਖ ਕੇ ਬਾਰ ਬਾਰ ਉਹਨੂੰ ਪੜਦੀ ਹਾਂ ਅਤੇ ਇਹਨੂੰ ਲ ਕਰਨਾ ਤਾਂ ਬਹੁਤ ਮ ਹੈ ਤਾਂ ਮਤਲਬ ਅਸਮਰਥ ਹੈ ਇਹਨੂੰ ਲੱਭਣਾ ਅਤੇ ਕਰਨਾ ਪਰ ਕਰਿਆ ਜਾ ਸਕਦਾ ਹੈ ਜੇ ਅਸੀਂ ਇਹਨੂੰ ਸ਼ਾਂਤੀ ਸ਼ਾਂਤੀ 'ਚ ਬਹਿ ਕੇ ਸ਼ਾਂਤ ਦਿਮਾਗ ਨਾਲ ਠੰਡੇ ਦਿਮਾਗ ਨਾਲ ਬੈਠ ਕੇ ਲਿਖੀਏ ਅਤੇ ਬਾਰ ਬਾਰ ਲਿਖੀ ਜਾਈਏ ਲਿਖੀ ਜਾਈਏ ਤਾਂ ਆਪਣੀ ਆਪ ਕਰੀਏਟਿੰਗ ਹੁੰਦੀ ਜਾਊਂਗੀ ਅਤੇ ਇਹਦਾ ਮੇਨ ਅੱਛੇ ਤਰੀਕੇ ਨਾਲ ਕੀਤਾ ਏ ਕਿਉਂਕਿ ਮੈਂ ਜਦੋਂ ਲਿਖਿਆ ਏ ਤਾਂ ਫਿਰ ਮੈਨੂੰ ਇਸ ਬਾਰੇ ਪਤਾ ਏ ਕਿ ਕਿਵੇਂ ਲਿਖਿਆ ਜਾ ਸਕਦਾ ਕਿਵੇਂ ਆਪਣੀ ਰਾਈਟਿੰਗ ਨੂੰ ਕ੍ਰੀਏਟਿਵ ਕੀਤਾ ਜਾ ਸਕਦਾ ਏ ਅਤੇ ਲਿਖ ਲਿਖ ਕੇ ਇਹਨੂੰ ਇੰਪਰੂਵ ਕੀਤਾ ਜਾ ਸਕਦਾ ਏ ਜਿਹੜਾ ਕਿ ਲੋਕਾਂ 'ਚ ਵੀ ਪਸੰਦ ਕੀਤਾ ਜਾ ਸਕੇ ਜਿਹੜਾ ਪੜ੍ਹਨ ਵਾਲਾ ਹੋਵੇ ਉਹ ਵੀ ਦੇਖੇ ਉਹਨੂੰ ਵੀ ਵਧੀਆ ਲੱਗੇ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਇਸ ਤਰਾਂ ਕ੍ਰੀਏਟਿਵ ਰਾਈਟਿੰਗ ਲਿਖੀ ਜਾ ਸਕਦੀ ਹੈ ਅਤੇ ਏ ਇਸ ਤਰ੍ਹਾਂ ਮੈਂ ਆਪਣੇ ਲਿਖਣ ਦੀ ਪਹਿਲੂ ਨੂੰ ਮਤਲਬ ਕਿ ਸੋਚ ਸਮਝ ਕੇ ਲਿਖ ਲੈਂਦੀ ਹਾਂ ਅਤੇ ਉਹਨੂੰ ਪਾਰ ਕਰ ਲੈਂਦੀ ਹਾਂ ਕੋਈ ਔਖਾ ਕੰਮ ਨਹੀਂ ਹੈ ਪਰ ਥੋੜ੍ਹਾ ਟਾਈਮ ਤਾਂ ਲੱਗਦਾ ਏ ਜਦੋਂ ਆਪਾਂ ਅਸੀਂ ਲਿਖਣ ਲੱਗ ਜਾਂਦੇ ਹਾਂ ਫ਼ਿਰ ਹੌਲੀ ਹੌਲੀ ਸਾਡਾ ਸਾਡੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਏ ਫਿਰ ਜ਼ਿਆਦਾ ਸੋਚਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਥੋੜ੍ਹਾ ਟਾਈਮ ਔਖਾ ਹੁੰਦਾ ਏ ਲਿਖਣ ਵਿੱਚ ਕਿਉਂਕਿ ਲਿਖਣਾ ਜ਼ਿਆ ਲਿਖਣਾ ਸੋਚ ਸਮਝ ਕੇ ਜਿਹਨੇ ਸ਼ੁਰੂ ਸ਼ੁਰੂਆਤ ਕੀਤੀ ਹੋਈ ਪਰ ਜਦੋਂ ਅਸੀਂ ਲਿਖਦੇ ਰਹਿੰਦੇ ਹਾਂ ਲਿਖਦੇ ਰਹਿੰਦੇ ਹਾਂ ਫ਼ਿਰ ਸਾਡੀਆਂ ਇੰਪਰੂਵਮੈਂਟ ਹੁੰਦੀ ਰਹਿੰਦੀ ਹੈ